ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਹੈ ਅਤੇ ਮੈਂ ਥੋੜ੍ਹੇ ਦਿਨ ਪਹਿਲਾਂ ਇੰਸਟਾਗ੍ਰਾਮ ਦੀ ਮਸ਼ਹੂਰੀ ਤੋਂ ਇੱਕ ਸਮਾਰਟ ਵਾਚ ਦਾ ਔਡਰ ਦਿੱਤਾ ਸੀ ਅਤੇ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਇਹ ਕੱਲ੍ਹ ਮਿਲ ਗਈ ਹੈ ਅਤੇ ਸਭ ਤੋਂ ਪਹਿਲਾਂ ਮੈਨੂੰ ਪੰਦਰਾਂ ਦਿਨਾਂ ਦਾ ਟਾਈਮ ਦਿਖਾਇਆ ਗਿਆ ਸੀ ਪਰ ਇਹ ਮੈਨੂੰ ਇੱਕ ਹਫ਼ਤੇ ਦੇ ਅੰਦਰ ਮਿਲ ਗਈ ਹੈ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਇਸ ਤੋਂ ਇਲਾਵਾ ਮੇਰੀ ਖੁਸ਼ੀ ਦਾ ਕਾਰਨ ਇਸਦੀ ਬਹੁਤ ਵਧੀਆ ਪੇਸ਼ਕਾਰੀ ਇਸਦੀ ਪੈਕਿੰਗ ਹੈ ਜਦੋਂ ਮੈਂ ਇਸਨੂੰ ਖੋਲ੍ਹਿਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ਼ ਪੈਕ ਕੀਤੀ ਹੋਈ ਸੀ ਅਤੇ ਉਸ ਤੋਂ ਇਲਾਵਾ ਜਦੋਂ ਮੈਂ ਇਸ ਘੜੀ ਦਾ ਉਪਯੋਗ ਕੀਤਾ ਤਾਂ ਮੈਂ ਇਸਦੇ ਫੀਚਰਜ਼ ਤੋਂ ਬਹੁਤ ਜ਼ਿਆਦਾ ਪ੍ਰਸੰਨ ਹਾਂ ਜਿਵੇਂ ਕਿ ਇਸ ਨੂੰ ਦੇਖਣ ਲਈ ਮੈਨੂੰ ਇਸਦਾ ਕੋਈ ਬਟਨ ਦੱਬਣ ਦੀ ਲੋੜ ਨਹੀਂ ਹੈ ਇਸਦਾ ਟਾਈਮ ਮੈਨੂੰ ਬਿਨਾਂ ਕੋਈ ਬਟਨ ਦੱਬੇੇ ਦਿਖ ਸਕਦਾ ਹੈ ਅਤੇ ਇਸਦਾ ਡਿਸਪਲੇਅ ਬਹੁਤ ਹੀ ਸਮੂਦ ਹੈ ਇਸ ਵਿੱਚ ਸਿਹਤ ਸੰਬੰਧੀ ਸਾਰੇ ਫੀਚਰ ਹਨ ਜਿਵੇਂ ਕਿ ਉੱਥੇ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਦਿਨ ਵਿੱਚ ਮੈਂ ਕਿੰਨਾ ਫਾਸਲਾ ਕਿੰਨੇ ਕਿਲੋਮੀਟਰ ਮੈਂ ਚੱਲੀ ਹਾਂ ਮੈਨੂੰ ਅਸਾਨੀ ਨਾਲ਼ ਦਿੱਖ ਸਕਦਾ ਹੈ ਅਤੇ ਇਹ ਮੈਨੂੰ ਮੇਰੇ ਪਾਣੀ ਪੀਣ ਦੇ ਨਿਯਮ ਬਾਰੇ ਵੀ ਦੱਸਦੀ ਰਹਿੰਦੀ ਹੈ ਇਸ ਤੋਂ ਇਲਾਵਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਤੁਹਾਡੀ ਸਰਵਿਸ ਬਹੁਤ ਹੀ ਵਧੀਆ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ਼ ਤੁਸੀਂ ਆਪਣੇ ਕਸਟਮਰ ਨੂੰ ਸਰਵਿਸ ਪ੍ਰਦਾਨ ਕਰਦੇ ਹੋ ਅਤੇ ਕੋਈ ਵੀ ਮੈਨੂੰ ਅਗਰ ਪੁੱਛੇਗਾ ਇਸਦੇ ਬਾਰੇ ਤਾਂ ਮੈਂ ਤੁਹਾਡਾ ਤੁਹਾਡਾ ਹੀ ਨਾਮ ਦੇਵਾਂਗੀ